ਮੱਛੀਆਂ ਪਹਿਲਾਂ ਫੜਨ ਦਾ ਤਰੀਕਾ ਪਹਿਲਾਂ ਇਸ ਤਰ੍ਹਾਂ ਦਾ ਹੁੰਦਾ ਸੀ ਜੋ ਕਿ ਕੁੰਡਿਆਂ ਨਾਲ ਇੱਕ ਇੱਕ ਮੱਛੀ ਫੜਦੇ ਹੁੰਦੇ ਸੀ ਹੁਣ ਮੱਛੀ ਹੁਣ ਇਸ ਇਸ ਤਰ੍ਹਾਂ ਫੜਦੇ ਹੈ ਕਾਫੀ ਬਦਲਾਅ ਹੋ ਗਿਆ ਹੁਣ ਆਉਣ ਵਾਲੇ ਟਾਈਮ 'ਚ ਜੋ ਕਿ ਹੁਣ ਹੁਣ ਜਾਲ ਵਿਛਾ ਕੇ ਪਾਣੀ ਦੇ ਵਿੱਚ ਜਾਲ ਪਹਿਲਾਂ ਤੋਂ ਵਿਛਾ ਕੇ ਫਿਰ ਉਸਦਾ ਵੇਟ ਕਰਕੇ ਵੇਟ ਕਰਨ ਤੋਂ ਬਾਅਦ ਮੱਛੀਆਂ ਜਾਲ ਦੇ ਵਿੱਚ ਆ ਜਾਂਦੀਆਂ ਹੈ ਉਸ ਤੋਂ ਬਾਅਦ ਜਾਲ ਨੂੰ ਇਕਠੇ ਹੋ ਕੇ ਖਿੱਚ ਲੈਂਦੇ ਹੈ ਫਿਰ ਸਾਰੀਆਂ ਮੱਛੀਆਂ ਜਾਲ 'ਚ ਇਕੱਠੀਆਂ ਸਟੋਕ ਹੋ ਜਾਂਦੀਆ ਹੈ ਫਿਰ ਮੱਛੀਆਂ ਨੂੰ ਬਾਹਰ ਕੱਢ ਲੈਂਦੇ ਹੈ ਪਹਿਲਾਂ ਚਲਦਾ ਸੀ ਕੁੰਡੀ ਵਾਲਾ ਤਰੀਕਾ ਹੁਣ ਜਾਲ ਨਾਲ ਮੱਛੀਆਂ ਫੜਦੇ ਹਨ ਉਦੋਂ ਥੋੜ੍ਹੀਆਂ ਮੱਛੀਆਂ ਆਉਂਦੀਆਂ ਹੁੰਦੀਆਂ ਸੀ ਹੁਣ ਤਰੀਕਾ ਬਦਲ ਗਿਆ ਹੁਣ ਇਕੱਠੀਆਂ ਮੱਛੀਆਂ ਆ ਜਾਂਦੀਆਂ ਹੈ ਫਿਰ ਉਸ ਤੋਂ ਬਾਅਦ ਮੱਛੀਆਂ ਫੜ ਕੇ ਕੱਢ ਕੇ ਪੈਕਿੰਗ ਕਰਕੇ ਵੇਚਦੇ ਹਨ ਜੋ ਕਿ ਪਹਿਲਾਂ ਮੱਛੀ ਫੜਨ 'ਚ ਮੁਸ਼ਕਿਲਾਂ ਜ਼ਿਆਦਾ ਆਉਂਦੀਆਂ ਹਨ ਹੁਣ ਕਈ ਤਰੀਕਿਆ 'ਚ ਬਦਲਾਅ ਹੋ ਗਿਆ ਹੁਣ ਮੱਛੀਆਂ ਜਾਲ ਨਾਲ ਫੜਦੇ ਆਸਾਨ ਹੋ ਗਿਆ ਪਹਿਲਾਂ ਨਾਲੋਂ ਸੌਖਾ ਕੰਮ ਹੁਣ ਹੋ ਚੁੱਕਿਆ ਹੈ ਹੁਣ ਹੁਣ ਮੱਛੀਆਂ ਫੜਨ ਦਾ ਤਰੀਕਾ ਬਹੁਤ ਸੌਖਾ ਹੈ ਹੁਣ ਕਾਫੀ ਬਦਲਾਅ ਹੋ ਗਿਆ ਹੈ ਹੁਣ ਵੀ ਇਸ ਤੋਂ ਜ਼ਿਆਦਾ ਕਾਫੀ ਟੈਮ ਬਾਅਦ ਹੁਣ ਵੀ ਮੱਛੀਆਂ ਫੜਨ ਦਾ ਤਰੀਕਾ ਬਹੁਤ ਆਸਾਨ ਹੋ ਗਿਆ ਹੈ ਕਈ ਸਮਾਨ ਹੁਣ ਇਹੋ ਜਿਹੇ ਆ ਗਏ ਜਿਸ ਨਾਲ ਮੱਛੀਆਂ ਸੌਖੀਆਂ ਫੜੀਆਂ ਜਾਂਦੀਆਂ ਹਨ